ਸਭ ਤੋਂ ਵਧੀਆ ਪੇਂਟਿੰਗ ਕਰਨਾ ਸੂਟਾਂ ਵਿੱਚ ਵਧੀਆ ਲੱਗਦਾ ਹੈ ਸੂਟਾਂ ਵਿੱਚ ਇੱਕ ਤੋਂ ਚਾਰ ਘੰਟੇ ਲੱਗ ਜਾਂਦੇ ਹਨ ਇਸ ਜੀ ਕਢਾਈ ਮੈਨੂੰ ਬਹੁਤ ਹੀ ਪਸੰਦ ਹੈ ਅਸੀਂ ਕਢਾਈ ਕਰਦੇ ਸਮੇਂ ਸਾਡੀਆਂ ਅੱਖਾਂ ਦੁਖਣ ਲੱਗਦੀਆਂ ਹਨ ਇਸ ਵਿੱਚ ਬਹੁਤ ਹੀ ਮਿਹਨਤ ਹਨ ਅਸੀਂ ਇਹ ਕੰਮ ਕਰਨ ਵਿੱਚ ਮੈਨੂੰ ਬਹੁਤ ਹੀ ਆਨੰਦ ਆਉਂਦਾ ਹੈ ਅਤੇ ਇਹ ਕੰਮ ਛੇਤੀ ਕਰਨਾ ਹੁੰਦਾ ਹੈ ਮੈਨੇ ਇੱਕ ਸੂਟ ਵਿੱਚ ਕਢਾਈ ਕੀਤੀ ਅਤੇ ਉਹ ਸੂਟ ਮੈਨੇ ਪਾ ਲਿੱਤਾ ਉਹ ਸੂਟ ਮੈਨੂੰ ਬਹੁਤ ਹੀ ਵਧੀਆ ਲੱਗਿਆ ਇਹ ਕਢਾਈ ਮੈਂ ਆਪਣੇ ਹਰ ਰੋਜ਼ ਕਰਦੇ ਹਨ ਅਤੇ ਇਸ ਵਿੱਚ ਮੈਨੂੰ ਪੈਸੇ ਮਿਲਦੇ ਹਨ ਅਤੇ ਸਭ ਤੋਂ ਜ਼ਿਆਦਾ ਮੈਂ ਮਿਹਨਤ ਕਰਦੀ ਹਨ ਕਢਾਈ ਕਰਕੇ ਮੈਨੂੰ ਸਹੇਲੀਆਂ ਵੀ ਪੈਸੇ ਦੇ ਦਿੰਦੀਆਂ ਹਨ ਮੈਂ ਆਪਣੀਆਂ ਸਹੇਲੀਆਂ ਦੇ ਸਕੋ ਸੂਟਾਂ ਵਿੱਚ ਵੀ ਕਢਾਈ ਕਰ ਦਿੰਦੀ ਹਨ ਅਤੇ ਉਹ ਮੈਨੂੰ ਵੀ ਬਹੁਤ ਹੀ ਵਧੀਆ ਮੰਨਦੇ ਹਨ